ਸਾਡੀ ਪੰਜਾਬੀ ਭਾਸ਼ਾ ਬੜੀ ਸੋਹਣੀ ਹੈ ਭਾਸ਼ਾ ਹੈ ਅਤੇ ਸੁਣਨ ਅਤੇ ਬੋਲਣ ਵਿੱਚ ਚੰਗੀ ਲੱਗਦੀ ਹੈ ਪਰ ਸਾਡੀ ਅਕਸਰ ਭਾਸ਼ਾ ਵਿੱਚ ਇੱਕ ਗੱਲ ਨਾਲ ਦੋ ਗੱਲਾਂ ਨਿਕਲ ਜਾਂਦੀਆਂ ਹਨ ਜੋ ਕਿ ਅਸੀਂ ਰੋਜ਼ਾਨਾ ਆਪਣੀ ਆਮ ਜ਼ਿੰਦਗੀ ਵਿੱਚ ਵਰਤਦੇ ਹਾਂ ਜਿਵੇਂ ਕਿ ਕਈ ਲੋਕ ਬੜੇ ਆਕੜ ਖਾਂ ਹੁੰਦੇ ਹਨ ਕਿ ਅਸੀਂ ਕਹਿ ਦਿੰਦੇ ਹਾਂ ਕਹਿ ਦਿੰਦੇ ਹਾਂ ਕਿ ਰੱਸੀ ਜਲ ਗਈ ਪਰ ਵਲ ਨਹੀਂ ਗਿਆ ਜੇ ਕੋਈ ਜੇ ਕੋਈ ਆਦਮੀ ਆਪਣਾ ਮਤਲਬ ਕੱਢ ਕੇ ਬੋਲਚਾਲ ਬੰਦ ਕਰ ਦਿੰਦਾ ਹੈ ਅਤੇ ਅਸੀਂ ਉਸ ਨੂੰ ਵੀ ਇਹ ਗੱਲ ਕਹਿੰਦੇ ਹਾਂ ਕਿ ਉਹ ਆਪਣਾ ਉੱਲੂ ਸਿੱਧਾ ਕਰਕੇ ਚਲਾ ਗਿਆ

ਅਕਸਰ ਆਪਣੇ ਭਾਈਚਾਰੇ ਨੂੰ ਸਾਡੀ ਬੋਲਚਾਲ ਦੀ ਭਾਸ਼ਾ ਭਾਸ਼ਾ ਵਿੱਚ ਵਰਤੀਆਂ ਜਾਣ ਵਾਲੀਆਂ ਇਹ ਆਮ ਗੱਲਾਂ ਵੀ ਵਿੱਚ ਹਨ ਲੋਕ ਕਹਿੰਦੇ ਹਨ ਕਿ ਅਸੀਂ ਕਈ ਗੱਲਾਂ ਵਿੱਚ ਆਪਣੇ ਦਿਲ ਦੀਆਂ ਗੱਲਾਂ ਨਾਲ ਆਪ ਇਹ ਗੱਲਾਂ ਕਰ ਲੈਂਦੇ ਹਾਂ ਕਈ ਕਿ ਕੁਝ ਇਹ ਹੁੰਦੇ ਹੈ ਕਿ ਮਾਵਾਂ ਵਾਰ੍ਹੇ ਕਿ ਮਾਵਾਂ ਬਹੁਤ ਹੀ ਚੰਗੀਆਂ ਹੁੰਦੀਆਂ ਹਨ ਅਤੇ ਲੋਕ ਕਹਿੰਦੇ ਹਨ ਮਾਵਾਂ ਠੰਢੀਆਂ ਛਾਵਾਂ ਹੁੰਦੀਆਂ ਹਨ ਇਸ ਲਈ ਅਸੀਂ ਕਦੀ ਵੀ ਮਾਵਾਂ ਨੂੰ ਮਾੜਾ ਚੰਗਾ ਨਹੀਂ ਆਖਦੇ ਕਿਉਂਕਿ ਸਾਡੇ ਲਈ ਮਾਵਾਂ ਹੀ ਮਾਵਾਂ ਠੰਢੀਆਂ ਛਾਵਾਂ ਹੁੰਦੀਆਂ ਹਨ ਥੈ ਧੰਨਵਾਦ